ਪੰਜਾਬੀ ਭਾਸ਼ਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਫੋਮ ਵਗੈਰਾ ਕਹਿ ਲਓ ਜਦੋਂ ਆਪਾਂ ਭਰਨੇ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਇੰਗਲਿਸ਼ ਲੈਂਗੁਏਜ ਆ ਉਹਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਪਰ ਪੰਜਾਬ ਦੇ ਵਿੱਚ ਜੇ ਆਪਾਂ ਜਿਵੇਂ ਸਰਕਾਰੀ ਸਾਰੇ ਕੰਮ ਲੈ ਕੇ ਚੱਲੀਏ ਜਨਮ ਮਿਤੀ ਤੋਂ ਲੈ ਕੇ ਤੁਸੀਂ ਕੋਈ ਵੀ ਜਾਤੀ ਸਰਟੀਫਿਕੇਟ ਬਣਾਉਣਾ ਹੋਵੇ ਜਾਂ ਕੁਛ ਵੀ ਬਣਾਉਣਾ ਹੋਵੇ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਫੋਰਮਸ ਆ ਉਹ ਕੀ ਹੈ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਮਿਲਣਗੇ ਇਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਨੂੰ ਕਾਫ਼ੀ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਕਹਿ ਲਓ ਜਿਵੇਂ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਜਿਹੋ ਜਿਹਾ ਜਮਾਨਾ ਹੈ ਸਾਰੇ ਜਿਹੜੇ ਆ ਵਿਦੇਸ਼ੀ ਭਾਸ਼ਾਵਾਂ ਵੱਲ ਸਭ ਦੀ ਰੁਚੀ ਜਿਹੜੀ ਆ ਉਹ ਵੱਧ ਰਹੀ ਹੈ ਜਿਵੇਂ ਕੋਈ ਏ ਇੰਗਲਿਸ਼ ਸਿੱਖਣਾ ਚਾਹ ਰਿਹਾ ਕੋਈ ਫਰੈਂਚ ਸਿੱਖਣਾ ਚਾਹ ਰਿਹਾ ਪਰ ਨਵਾਂ ਸਿੱਖਣ ਦੇ ਨਾਲ ਨਾਲ ਕੀ ਹੋ ਰਿਹਾ ਵਾ ਕਿ ਪੁਰਾਣਾ ਜਿਹੜੇ ਤੁਹਾਡੀ ਕਹਿ ਲਓ ਮਾਂ ਬੋਲੀ ਹੈਗੀ ਹੈ ਉਹਨੂੰ ਪੜ੍ਹਨ ਸੁਣਨ ਜਾਂ ਲਿਖਣ ਦੇ ਵਿੱਚ ਜਿਹੜੇ ਬੱਚੇ ਆ ਉੰਨੇ ਹੀ ਕਮਜ਼ੋਰ ਹੋ ਰਹੇ ਪਰ ਇਹ ਬੜੇ ਵਧੀਆ ਗੱਲ ਹੈਗੀ ਹੈ ਕਿ ਜਿਵੇਂ ਜਿਹੜੇ ਵੀ ਸਰਕਾਰੀ ਕੰਮ ਕਿਉਂਕਿ ਸਰਟੀਫਿਕੇਟ ਵਗੈਰਾ ਦੀ ਲੋੜ ਤਾਂ ਸਭ ਨੂੰ ਪੈਂਦੀ ਹੈ ਜਿਵੇਂ ਤੁਸੀਂ ਜੇ ਰੈਜੀਡੈਂਸ ਸਰਟੀਫਿਕੇਟ ਹੀ ਲੈ ਕੇ ਚੱਲੋ ਠੀਕ ਆ ਜਾਤੀ ਸਰਟੀਫਿਕੇਟ ਲੈ ਕੇ ਚੱਲੋ ਤਾਂ ਇਹਨਾਂ ਦੀ ਲੋੜ ਤਾਂ ਸਭ ਨੂੰ ਹੁੰਦੀ ਹੀ ਇਹ ਟਾਈਮ ਟੂ ਟਾਈਮ ਸੋ ਇਹੋ ਜਿਹੀਆਂ ਚੀਜ਼ਾਂ ਜਦੋਂ ਪੰਜਾਬੀ ਭਾਸ਼ਾ ਦੇ ਵਿੱਚ ਹੋਣਗੀਆਂ ਤਾਂ ਸਭ ਨੂੰ ਪਤਾ ਹੈ ਕਿ ਹਾਂਜੀ ਅੱਜ ਨਹੀਂ ਤਾਂ ਅੱਗੇ ਚੱਲ ਕੇ ਸਾਨੂੰ ਇਹਨਾਂ ਸਭ ਚੀਜ਼ਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਹੀ ਪਵੇਗਾ ਕਿ ਫੋਰਮ ਵਗੈਰਾ ਜਿਹੜੇ ਜਿਸ ਤਰ੍ਹਾਂ ਕਹਿ ਲਓ ਕਿਸੇ ਵੇਲੇ ਖੁਦ ਭਰਨੇ ਪੈਂਦੇ ਅਲੱਗ ਕਿਸੇ ਨੂੰ ਮਦਦ ਲਈ ਕੋਈ ਨਹੀਂ ਹੁੰਦਾ ਤਾਂ ਅਜਿਹੀ ਹਾਲਤ ਦੇ ਵਿੱਚ ਕੀ ਆ ਖੁਦ ਨੂੰ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਣੀ ਚਾਹੀਦੀ ਆ ਜਿਹਦੇ ਨਾਲ ਕਿ ਆ ਤੁਸੀਂ ਆਪਣਾ ਕੰਮ ਬੜੇ ਇਹ ਵਧੀਆ ਤਰੀਕੇ ਦੇ ਨਾਲ ਬਿਨਾਂ ਕਿਸੇ 'ਤੇ ਨਿਰਭਰ ਹੋਏ ਕਰ ਸਕਦੇ ਹੋ ਸੋ ਮੈਂ ਇਸ ਚੀਜ਼ ਨੂੰ ਬੜੇ ਹੀ ਵਧੀਆ ਮਤਲਬ ਕਹਿ ਲਓ ਮੰਨਦੀ ਹਾਂ ਵਪਾਰ ਅਤੇ ਵਣਜ ਦੇ ਵਿੱਚ ਹੁਣ ਜਿਵੇਂ ਅਸੀਂ ਆਪਣੀ ਪੈਲੀ ਦੇ ਗੱਲ ਕਰੀਏ ਤਾਂ ਪੈਲੀ ਦੇ ਵੀ ਜਿੰਨੇ ਵੀ ਕਾਗਜ਼ ਹੁੰਦੇ ਨੇ ਜਾਂ ਫਾਰਮ ਹੁੰਦੇ ਨੇ ਜਿਹੜੀਆਂ ਸਰਕਾਰੀ ਬੈਂਕਾਂ ਹੈਗੀਆਂ ਨੇ ਉਹ ਜ਼ਿਆਦਾਤਰ ਪੰਜਾਬੀ ਦੇ ਵਿੱਚ ਹੀ ਲੈਣ ਦੇਣ ਜਿਹੜਾ ਹੈ ਉਹ ਕਰਦੀਆਂ